ਤੈਰਾਕੀ ਸਾਡੀ ਸਿਹਤ ਨੂੰ ਚੰਗਾ ਬਣਾਉਣ ਵਾਸਤੇ ਇੰਨਾ ਸੋਹਣਾ ਸਾਧਨ ਹੈ ਕਿ ਤੁਸੀਂ ਇਸ ਦੀ ਕਲਪਨਾ ਨਹੀਂ ਕਰ ਸਕਦੇ ਤੈਰਾਕੀ ਸਮਝ ਲਓ ਕਿ ਸੰਪੂਰਨ ਵਿਆਮ ਹੈ ਜੋ ਵਿਅਕਤੀ ਕੋਈ ਯੋਗਾ ਆਸਣ ਜਾਂ ਕਿਸੇ ਜ਼ਿੰਮ ਵਿੱਚ ਜਾ ਕਰਕੇ ਕੁਝ ਨਹੀਂ ਕੁਝ ਕਰਦਾ ਮੈਂ ਕਹਿੰਦਾ ਹਾਂ ਕਿ ਅੱਧਾ ਘੰਟਾ ਵੀ ਅਗਰ ਉਹ ਤੈਰਾਕੀ ਕਰ ਲਵੇ ਤਾਂ ਉਸਨੂੰ ਹੋਰ ਕੋਈ ਵੀ ਵਿਆਮ ਕਰਨ ਦੀ ਜ਼ਰੂਰਤ ਨਹੀਂ ਹੈ ਇਹ ਸਾਡੇ ਸਰੀਰ ਦੇ ਅਨੇਕਾਂ ਹੀ ਰੋਗਾਂ ਜਿਵੇਂ ਸਾਨੂੰ ਫੇਫੜਿਆਂ ਦੀ ਕੋਈ ਬਿਮਾਰੀ ਹੈ ਜਾਂ ਸੰਭਾਵਨਾ ਹੈ ਐਸੀ ਸਾਹ ਦੀ ਕੋਈ ਬਿਮਾਰੀ ਹੈ ਜਾਂ ਸਾਡੇ ਮੋਢਿਆਂ ਵਿੱਚ ਸਾਡੇ ਜੋੜਾਂ ਵਿੱਚ ਕੋਈ ਦਿੱਕਤ ਹੈ ਅਗਰ ਅਸੀਂ ਤੈਰਾਕੀ ਦਾ ਅਭਿਆਸ ਕਰਦੇ ਹਾਂ ਇਹ ਸਿੱਧ ਹੈ ਵਿਚਾਰ ਕਿ ਉਸ ਨੂੰ ਇਹਨਾਂ ਬਿਮਾਰੀਆਂ ਤੋਂ ਇਹਨਾਂ ਰੁਕਾਵਟਾਂ ਤੋਂ ਰਾਹਤ ਮਿਲਦੀ ਹੈ ਧੰਨਵਾਦ